ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨ ਸਿੰਘ ਪਿੰਡ ਝੁੰਬੇ ਤੋਂ ਬੋਲ ਰਿਹਾਂ ਹਾਂ ਵੀਰੇ ਅਸੀਂ ਥੋੜ੍ਹੇ ਦਿਨ ਪਹਿਲਾਂ ਤੁਹਾਡੇ ਕੋਲੋਂ ਇੱਕ ਕੂਲਰ ਮੰਗਵਾਇਆ ਸੀ ਜਿਸ ਦੇ ਵਿੱਚ ਬਹੁਤ ਕਮੀਆਂ ਹਨ ਜਿਵੇਂ ਕਿ ਨਾ ਹੀ ਤਾਂ ਉਹ ਇੰਨਾ ਉਹਦੀ ਮੋਟਰ ਕੰਮ ਕਰਦੀ ਹੈ ਵੀ ਚਲਦੀ ਚਲਦੀ ਰੁਕ ਜਾਂਦੀ ਹੈ ਔਰ ਨਾ ਹੀ ਉਹ ਆਪਣਾ ਪੰਪ ਵਗੈਰਾ ਉਹਦਾ ਜਿਹੜੀ ਮੋਟਰ ਪੰਪ ਦੀ ਹੈ ਉਹ ਵੀ ਫਾਲਟੀ ਜਿਹੀ ਹੈ ਉਹ ਵੀ ਐਨਾ ਠੀਕ ਨੀਗੀ ਅਤੇ ਕੂਲਰ ਦੇ ਵਿੱਚ ਜਦੋਂ ਪਾਣੀ ਪਾ ਦਿੰਦੇ ਹਾਂ ਉਹਨਾਂ ਨੂੰ ਉਹ ਕੂਲਰ ਦਾ ਜਿਹੜੀ ਚਾਦਰ ਹੈ ਉਹ ਜੰਗਾਲ ਫੜੀ ਜਾਂਦੀ ਹੈ ਅਤੇ ਫੈਨ ਵਗੈਰਾ ਅਤੇ ਮੋਟਰ ਦੇ ਵਿੱਚ ਖੜ ਖੜ ਜਿਵੇਂ ਕਿ ਕੋਈ ਬੁਸ਼ ਬੈਰਿੰਗ ਹੈ ਉਹ ਆਵਾਜ਼ ਬਹੁਤ ਕਰਦੇ ਹੈ ਜਿਹਦੇ ਨਾਲ ਬੱਚਿਆਂ ਨੂੰ ਸੌਣ ਦੇ ਵਿੱਚ ਕਨਫਿਊਜ਼ਨ ਹੈ ਅਸੀਂ ਤੁਹਾਨੂੰ ਬਹੁਤ ਹੀ ਚੰਗਾ ਸਮਝ ਕੇ ਤੁਹਾਡੀ ਸਰਵਿਸ ਇਸ ਕਰਕੇ ਤੁਹਾਡੇ ਕੋਲੋਂ ਇਹ ਸਮਾਨ ਮੰਗਵਾਇਆ ਸੀ ਹੁਣ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਚੱਲ ਗਿਆ ਵੀ ਇਹ ਜੋ ਸਮਾਨ ਹੈ ਸਹੀ ਨਹੀਂ ਆਪਣੇ ਕੋਲ ਭੇਜ ਸਕਦੇ ਤਾਂ ਅਗਾਂਹ ਤੋਂ ਅਸੀਂ ਤੁਹਾਡੇ ਕੋਲੋਂ ਕੋਈ ਵੀ ਚੀਜ਼ ਇਹੋ ਜਿਹੀ ਟਾਈਮ ਦੇ ਉੱਤੇ ਕੋਈ ਵੀ ਮੌਸਮ ਦੇ ਵਿੱਚ ਕਿਸੇ ਵੀ ਸਮੇਂ ਸੀਜਨ ਦੇ ਵਿੱਚ ਨਹੀਂ ਮੰਗਾਵਾਂਗੇ ਕਿਉਂਕਿ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਸਾਡਾ